ਪਹਿਲੇ ਸਮੇਂ ਦੇ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਤਕਨੋਲਜੀ ਨੇ ਬਹੁਤ ਵੱਡਾ ਯੋਗਦਾਨ ਕੀਤਾ ਹੈ ਕਿਉਂਕਿ ਪਹਿਲਾਂ ਸਾਨੂੰ ਆਪਣਾ ਜਿਹੜਾ ਕੈਸ਼ ਏ ਉਹ ਜਾਣੀ ਕਿ ਬਾਈ ਹੈਂਡ ਡਿਰੀਵਲ ਕਰਨਾ ਪੈਂਦਾ ਸੀ ਹੁਣ ਅਸੀਂ ਆਪਣੇ ਕੈਸ਼ ਦਾ ਭੁਗਤਾਨ ਆਉਣ ਲਾਈਨ ਆਪਣਾ ਕਰਦੇ ਹਾਂ ਔਨਲਾਈਨ ਕਰਨ ਦੇ ਨਾਲ ਸਾਡੇ ਸਮੇਂ ਦੀ ਵੀ ਬੱਚਤ ਹੈ ਕਿਉਂਕਿ ਸਾਡਾ ਜਿਹੜਾ ਭੁਗਤਾਨ ਹੈ ਉਹ ਵੀ ਸਮੇਂ ਸਿਰ ਹੁੰਦਾ ਹੈ ਇਹ ਜੋ ਚੀਜ਼ ਹੈ ਇਹ ਜਾਣੀ ਕਿ ਇੱਕ ਬਹੁਤ ਵੱਡੀ ਹੀ ਆਪਣਾ ਤੈਕਨੋਲਜੀ ਹੈ